ਸਤਿ ਸ਼੍ਰੀ ਅਕਾਲ ਹਾਂਜੀ ਸਾਡੇ ਜ਼ਿਲ੍ਹੇ ਵਿੱਚ ਬੱਚਿਆਂ ਦੇ ਜਾਂ ਵਿਦਿਆਰਥੀ ਦੇ ਵਿਕਾਸ ਲਈ ਕਈ ਚੀਜ਼ਾਂ ਕਰਵਾਈ ਜਾਂਦੀ ਇੱਥੇ ਜੇ ਸਾਨੂੰ ਕੋਈ ਜੇ ਈ ਮੀਨਸ ਦੀ ਤਿਆਰੀ ਕਰਨੀ ਹੋਵੇ ਜਾਂ ਨੀਟ ਦੀ ਤਿਆਰੀ ਕਰਨੀ ਹੋਵੇ ਕਿੰਨੀ ਸਾਰੀ ਸੰਸਥਾਵਾਂ ਅਤੇ ਕੋਚਿੰਗ ਸੈਂਟਰ ਇੱਥੇ ਖੁੱਲ੍ਹੇ ਹੋਏ ਆ ਜਿਨ੍ਹਾਂ 'ਚ ਮੈਂ ਕੁਝ ਅਗਰ ਨਾਮ ਲਵਾਂਗੀ ਜਿੱਦਾਂ ਕਿ ਗਿਆਨਮ ਹੋ ਗਿਆ ਆਈ ਬੀ ਟੀ ਹੋ ਗਿਆ ਜੋ ਇਹ ਸਾਰੇ ਇੰਸਟੀਟਿਊਟ ਹੈਗੇ ਆ ਇਹ ਸੰਸਥਾ ਹੈਗੇ ਆ ਜੇ ਸਾਨੂੰ ਕੋਈ ਪੁਲਿਸ ਦੀ ਤਿਆਰੀ ਕਰਨੀ ਹੋਵੇ ਜਾਂ ਐੱਸ ਐੱਸ ਸੀ ਦਾ ਇਗਜਾਮ ਕਲੀਅਰ ਕਰਨਾ ਹੋਵੇ ਜਾਂ ਪੀ ਸੀ ਐੱਸ ਦਾ ਇਗਜ਼ਾਮ ਕਲੀਅਰ ਕਰਨਾ ਹੋਵੇ ਉਹਨਾਂ ਦੀ ਇਹ ਤਿਆਰੀ ਕਰਵਾਉਂਦਾ ਹੈ ਬੱਚਿਆਂ ਨੂੰ ਇਹ ਸਕਾਲਰਸ਼ਿਪ ਵੀ ਪ੍ਰੋਵਾਈਡ ਕਰਦਾ ਜੋ ਬਹੁਤ ਵਧੀਆ ਜੋ ਹੁਸ਼ਿਆਰ ਬੱਚੇ ਹੁੰਦੇ ਆ ਉਹਨਾਂ ਤੋਂ ਪਬ ਪਹਿਲਾਂ ਇਹ ਪੇਪਰ ਲੈਂਦਾ ਹੈ ਫਿਰ ਪੇਪਰ ਲੈਣ ਤੋਂ ਬਾਅਦ ਇਹ ਉਹਨਾਂ ਦੀ ਕਿੰਨੀ ਫੀਸ ਮਾਫ ਕਰਦਾ ਪੜ੍ਹਾਉਣ ਲਈ ਅਤੇ ਉਹਨਾਂ ਨੂੰ ਕਿੰਨਾ ਸਾਰਾ ਕਿਤਾਬਾਂ ਦਿੰਦੇ ਆ ਪ੍ਰਦਾਨ ਕਰਦੇ ਹੈਗੇ ਤਾਂ ਕਿ ਬੱਚਾ ਅੱਗੇ ਜਾਵੇ ਅਤੇ ਉਹਨਾਂ ਦੇ ਸੰਸਥਾ ਸਿਧਾਂਤ ਦੇ ਨਾਲ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕਰੇ ਜੋ ਉਹਦੇ ਇਲਾਵਾ ਜੇ ਕੀ ਬੱਚਾ ਕੰਪਿਊਟਰ 'ਚ ਜਾਣਾ ਚਾਹੁੰਦਾ ਹੈਗਾ ਟੈਕਨੋਲੋਜੀ ਨੂੰ ਵਧਾਉਣਾ ਚਾਹੁੰਦਾ ਹੈ ਉਹਦੇ ਆਪਣੇ ਚੀਜ਼ਾਂ ਨੂੰ ਵਧੀਆ ਕਰਨਾ ਚਾਹੁੰਦਾ ਅਤੇ ਇੱਥੇ ਇੱਕ ਵੀ ਐੱਮ ਐੱਮ ਨਾਮ ਦਾ ਸੰਸਥਾ ਹੈਗੀ ਆ ਅਲੈਗਜੈਂਡਰ ਸਕੂਲ ਦੇ ਕੋਲ ਜੋ ਕਿ ਪ੍ਰਦਾਨ ਕਰਦੀ ਆ ਪੜ੍ਹਾਈ ਹੋਵੇ ਅਤੇ ਕਈ ਸਾਰੇ ਸਕੂਲਾਂ ਅਤੇ ਸੰਸਥਾ ਦਾ ਵਾ ਨਾਮ ਲਵਾਂਗੇ ਜਿਵੇਂ ਗਵਰਮੈਂਟ ਪੋਲੀਟੈਕਨਿਕ ਕੋਲਜ ਹੋ ਗਿਆ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋ ਗਿਆ ਡੀ ਏ ਵੀ ਕੋਲਜ ਹੋ ਗਿਆ ਜਾਂ ਆਈ ਕੇ ਜੀ ਪੀ ਟੀ ਯੂ ਅੰਮ੍ਰਿਤਸਰ ਕੋਲਜ ਹੋ ਗਿਆ ਇੱਥੇ ਬੱਚੇ ਕਾਫੀ ਘੱਟ ਫੀਸ 'ਤੇ ਪੜ੍ਹਦੇ ਹੈਗੇ ਆ ਸਕੋਲਰਸ਼ਿਪ ਬੇਸਿਸ 'ਤੇ ਉਹਨਾਂ ਦੀ ਪੰਜਾਹ ਪ੍ਰਸੈਂਟ ਟਿਊਸ਼ਨ ਮਾਫ ਹੁੰਦੀ ਆ ਅਤੇ ਮੇਰੇ ਖਿਆਲ ਨਾਲ ਸਰਕਾਰੀ ਸਕੂਲਾਂ 'ਚ ਵੀ ਅੱਜ ਕੱਲ੍ਹ ਹੁਣ ਬਹੁਤ ਠੀਕ ਹਾਲ ਹੋ ਗਏ ਆ ਪੰਜਾਬ ਦੀ ਜੋ ਚੀਫ ਮਨਿਸਟਰ ਹੈਗੇ ਆ ਅਤੇ ਪੰਜਾਬ ਦੀ ਜੋ ਵੀ ਲੋਕ ਹੈਗੇ ਆ ਉਹ ਇਹਨਾਂ 'ਤੇ ਧਿਆਨ ਦਿੰਦੇ ਕਿ ਬੱਚੇ ਇੱਥੇ ਵਧੀਆ ਤਰੀਕੇ ਨਾਲ ਪੜ੍ਹਦੇ ਪਏ ਆ ਜਾਂ ਨਹੀਂ ਜਾਂ ਅਗਰ ਬੱਚਿਆਂ 'ਤੇ ਉੱਥੇ ਇੰਸਪੈਕਸ਼ਨ ਹੁੰਦੇ ਆ ਅਗਰ ਬੱਚੇ ਨਹੀਂ ਸਹੀ ਕਰ ਰਹੇ ਹੁੰਦੇ ਤਾਂ ਉਹਨਾਂ 'ਤੇ ਬਹੁਤ ਮਹੱਤਵਪੂਰਨ ਮਹੱਤਵਪੂਰਨ ਅਗੇਂਸਟ ਐਕਸ਼ਨ ਲੀਏ ਜਾਂਦੇ ਹੈ ਇੱਧਰ ਧੰਨਵਾਦ ਜੀ